ਮੇਰੇ ਕੋਲ ਬੁਣਾਈ ਜਾਂ ਸਿਲਾਈ ਦਾ ਕੋਈ ਨਿੱਜੀ ਤਜ਼ਰਬਾ ਨਹੀਂ ਹੈ ਪਰ ਮੈਂ ਤੁਹਾਨੂੰ ਰੰਗਾਂ ਦੀ ਚੋਣ ਕਰਨ ਲਈ ਕੁਝ ਆਮ ਸੁਝਾਅ ਦੇ ਸਕਦੀ ਹਾਂ ਜੋ ਕਿ ਬੁਣਾਈ ਅਤੇ ਸਿਲਾਈ ਦੇ ਪ੍ਰੋਜੈਕਟਾਂ ਲਈ ਮਦਦਗਾਰ ਹੋ ਸਕਦੇ ਹਨ ਪ੍ਰੇ ਪ੍ਰੇਰਨਾ ਲੱਭੋ ਕੁਦਰਤ ਕਲਾ ਫੈਸ਼ਨ ਰਸਾਲੇ ਜਾਂ ਇੰਟਰਨੈੱਟ ਤੋਂ ਪ੍ਰੇ ਪ੍ਰੇਰਨਾ ਲਓ ਉਹ ਰੰਗ ਚੁਣੋ ਜੋ ਤੁਹਾਡੇ ਆਕਰਸ਼ਤ ਕਰਦੇ ਹਨ ਅਤੇ ਤੁਹਾਡੇ ਪ੍ਰੋਜੈਕਟ ਲਈ ਸਹੀ ਮਹੌਲ ਬਣਾਉਂਦੇ ਹਨ ਰੰਗ ਚੱਕਰ ਦੀ ਵਰਤੋਂ ਕਰੋ ਰੰਗ ਚੱਕਰ ਤੁਹਾਨੂੰ ਰੰਗਾਂ ਦੇ ਵਿਚਕਾਰ ਸੰਬੰਧਾਂ ਨੂੰ ਸਮਝਾਉਣ ਵਿੱਚ ਮਦਦ ਕਰ ਸਕਦਾ ਹੈ ਤੁਸੀਂ ਇੱਕ ਸੁਰਤਾ ਲਈ ਪੂਰਕ ਪੂਰਕ ਰੰਗ ਇੱਕ ਦੂਜੇ ਦੇ ਵਿਰੁੱਧ ਜਾਂ ਸਮਾਨ ਰੰਗਾਂ ਇੱਕ ਦੂਜੇ ਦੇ ਨੇੜੇ ਦੀ ਵਰਤੋਂ ਕਰ ਸਕਦੇ ਹੋ